ਪੰਜਾਬ ਵਿੱਚ ਕਾਰੋਬਾਰ ਦੇ ਬਹੁਤ ਸਾਰੇ ਮੌਕੇ ਹਨ ਬਸ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਮੈਂ ਉਦਾਹਰਨ ਦਿੰਦਾ ਬੈਟਰੀ ਰਿਪੇਅਰ ਦੀ ਜਿਹੜੀ ਇੱਕ ਬੈਟਰੀ ਖਰਾਬ ਹੋ ਜਾਂਦੀ ਆ ਉਹਨੂੰ ਦੁਬਾਰਾ ਠੀਕ ਕਰਕੇ ਦੁਬਾਰਾ ਕੰਮ ਵੀ ਵਰਤੋਂ ਵਿੱਚ ਲਿਆਣ ਲਈ ਆਹ ਵਾ ਆਹ ਵਾਲੇ ਕਾਰੋਬਾਰ ਅੱਜ ਕੱਲ੍ਹ ਬਹੁਤ ਚੱਲ ਰਿਹਾ ਇੱਕ ਵੈਜੀਟੇਬਲ ਦਾ ਫਸ ਵੈਜੀਟੇਬਲ ਮਤਲਬ ਸਬਜ਼ੀ ਦਾ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਸਬਜ਼ੀ ਦਾ ਕੰਮ ਸ ਬਾਰਾਂ ਮਹੀਨੇ ਆ ਲੋਕ ਕੰਮ ਕਰਨ ਨਾ ਕਰਨ ਸਬਜ਼ੀ ਤਾਂ ਉਹਨਾਂ ਖਾਣੀ ਹੀ ਖਾਣੀ ਹੈ ਇਸ ਵੇਲੇ ਅੱਜ ਪਰ ਅੱਜ ਕੱਲ੍ਹ ਦੀ ਸਬਜ਼ੀ ਜ਼ਿਆਦਾ ਐਕਸਪੋਰਟ ਹੋ ਰਹੀ ਆ ਬਾਹਰ ਦੇ ਮੁਲਕਾਂ ਵਿੱਚ ਜਾਂ ਬਾਹਰ ਦੀ ਦੇ ਸਟੇਟਾਂ ਵਿੱਚ ਬਹੁਤ ਜ਼ਿਆਦਾ ਸਬਜ਼ੀ ਜਾ ਰਹੀ ਹੈ ਜੰਮੂ ਕਸ਼ਮੀਰ ਵਿੱਚ ਕਿਉਂਕਿ ਉੱਥੇ ਸ ਮੌਸਮ ਦੇ ਏ ਹਿਸਾਬ ਨਾਲ ਸਬਜ਼ੀ ਜ਼ਿਆਦਾ ਨਹੀਂ ਹੁੰਦੀ ਅਤੇ ਅੱਜ ਕੱਲ੍ਹ ਲੋਕ ਜ਼ਿਆਦਾ ਔਰਗੈਨਿਕ ਸਬਜ਼ੀ ਨੂੰ ਜ਼ਿਆਦਾ ਤਰਜੋ ਦਿੰਦੇ ਹਨ ਤਾਂ ਕਿ ਆਪਣੀ ਸਿਹਤ ਦੇ ਪ੍ਰਤੀ ਉਹ ਜ਼ਿਆਦਾ ਜਾਗਰੂਕ ਹੋ ਗਏ ਹਨ ਕਿਉਂਕਿ ਦੂਸਰੀ ਸਬਜ਼ੀ ਕੈਮੀਕਲ ਦੇ ਨਾਲ ਤਿਆਰ ਹੁੰਦੀ ਹੈ ਅਤੇ ਜਿਹੜੀ ਔਰਯਗੈਨਿਕ ਸਬਜ਼ੀ ਹੈ ਉਹ ਬਿਨਾਂ ਕੈਮੀਕਲ ਤੋਂ ਤਿਆਰ ਹੁੰਦੀ ਹੈ